ਹਾਂਜੀ ਮੈਂ ਕੁਛ ਇਹੋ ਜਿਹੀ ਸੰਸਥਾਵਾਂ ਨੂੰ ਜਾਣਦੀ ਹਾਂ ਜੋ ਕਿ ਪੇਂਡੂ ਔਰਤਾਂ ਨੂੰ ਸਿੱਖਿਆ ਅਤੇ ਮਦਦ ਕਰਦੀ ਹੈ ਵੂਮੈਨ ਵੈਲਫੇਅਰ ਸੋਸਾਇਟੀ ਐਂਡ ਸੇਵਾ ਭਾਰਤੀ ਸੰਸਥਾਵਾਂ ਬਣੀਆਂ ਹੋਈਆਂ ਹਨ ਜਿੱਥੇ ਕਿ ਔਰਤਾਂ ਨੂੰ ਸਿੱਖਿਆ ਅਤੇ ਸਿੱਖਿਆ ਅਤੇ ਤੌਰ 'ਤੇ ਕੰਮ ਕਾਰ ਕੰਮ ਦਿੰਦੀਆਂ ਹਨ ਤਾਂ ਕਿ ਉਹਨਾਂ ਦਾ ਗੁਜ਼ਾਰਾ ਹੋ ਸਕੇ ਅੱਜ ਕੱਲ੍ਹ ਬਹੁਤ ਹੀ ਮਹਿੰਗਾਈ ਵੱਧ ਰਹੀ ਹੈ ਅਤੇ ਔਰਤਾਂ ਨੂੰ ਵੀ ਔਰਤਾਂ ਨੂੰ ਵੀ ਕੰਮ ਕਾਰ ਕਰਨਾ ਚਾਹੀਦਾ ਹੈ ਅਤੇ ਨਵੀਂ ਨਵੇਂ ਕਿੱਤਿਆਂ ਬਾਰੇ ਦੱਸਦੀ ਹੈ ਔਰਤਾਂ ਬਹੁਤ ਹੀ ਸਿੱਖਿਆ ਦੇ ਤੌਰ 'ਤੇ ਕੰਮ ਕਰ ਲੈਂਦੀਆਂ ਹਨ